ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਦਾ ਰੁਝਾਨ ਬਹੁਤ ਵੱਧ ਰਿਹਾ ਹੈ ਲੋਕ ਅੱਜ ਕੱਲ੍ਹ ਸਭ ਕੁਝ ਹੀ ਔਨਲਾਈਨ ਹੀ ਮੰਗਵਾਉਂਦੇ ਰਹਿੰਦੇ ਹਨ ਔਨਲਾਈਨ ਸ਼ੋਪਿੰਗ 'ਤੇ ਕਾਫ਼ੀ ਪਲੇਟ ਪਲੇਟਫਾਰਮ ਹਨ ਜਿਵੇਂ ਔਨਲਾਈਨ ਐਮਾਜ਼ੋਨ ਫਲਿੱਪਗਾਡ ਮੀਸ਼ੋ ਸ਼ੋਪਿੰਗ ਮੋਸ਼ ਅਤੇ ਕਈ ਹੋਰ ਹਨ ਇਹਨਾਂ ਨਾਲ ਕ ਹੁਣ ਤਾਂ ਬਜ਼ਾਰਾਂ 'ਤੇ ਕੁੱਝ ਅਸਰ ਪਿਆ ਹੈ ਔਨਲਾਈਨ ਸ਼ੋਪਿੰਗ ਤੋਂ ਅਸੀਂ ਘਰ ਬੈਠੇ ਹੀ ਸਮਾਨ ਮੰਗਵਾ ਸਕਦੇ ਹਾਂ ਔਨਲਾਈਨ ਸ਼ੋਪਿੰਗ ਤੋਂ ਕਈ ਵਾਰ ਸਮਾਨ ਖ਼ਰਾਬ ਵੀ ਆ ਜਾਂਦਾ ਹੈ ਇਹ ਚੰਗਾ ਵੀ ਹੈ ਅਤੇ ਮਾੜਾ ਵੀ ਹੈ